ਸਰਕਾਰ ਸਾਨੂੰ ਬਹੁਤ ਹੀ ਸਕੀਮਾਂ ਦਿੰਦੀ ਹੈ ਜਿਵੇਂ ਕਿ ਸਿਹਤ ਵਾਸਤੇ ਪੋਲੀਸੀ ਪੋਲੀਸੀ ਕਰਾ ਕਰਾਉਣੀ ਇੰਸ਼ੋਰੈਂਸ ਵਗੈਰਾ ਇੰਸ਼ੋਰੈਂਸ ਕਰਾਉਣ ਵਿੱਚ ਇੰਸ਼ੋਰੈਂਸ ਦਾ ਵੀ ਸਾਨੂੰ ਲਾਭ ਇੰਸ਼ੋਰੈਂਸ ਵੀ ਕਰਾਈ ਹੋਈ ਹੈ ਜਿਸਦਾ ਕਿ ਅਸੀਂ ਸਾਨੂੰ ਕੋਈ ਪ੍ਰੇਸ਼ਾਨੀ ਆਪਣੀ ਜਾਂ ਸਿਹਤ ਵੱਲੋਂ ਜੋ ਆਏਗੀ ਅਤੇ ਅਸੀਂ ਆਪਣਾ ਇਲਾਜ ਕਰਵਾ ਸਕਦੇ ਹਾਂ ਦੂਜੇ ਦੋ ਨੰਬਰ 'ਤੇ ਇੱਕ ਸਰਕਾਰ ਵੱਲੋਂ ਪੰਜ ਲੱਖ ਦਾ ਕਾਰਡ ਵੀ ਬਣਵਾ ਕੇ ਦਿੱਤਾ ਜਾਂਦਾ ਹੈ ਜਿਹਦੇ ਵਿੱਚ ਪੰਜ ਲੱਖ ਜੋ ਹੈ ਪੰਜ ਲੱਖ ਰੁਪਏ ਸਰਕਾਰ ਲਾਉਂਦੀ ਹੈ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਲਾਜ ਕਰਾਉਣਾ ਪਵੇ ਤਾਂ ਸਾਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਝੱਲਣੀ ਪੈਂਦੀ ਸਾਨੂੰ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਹੀ ਲੈ ਕੇ ਜਾਣਾ ਪੈਂਦਾ ਹੈ ਹੋਸਪੀਟਲ ਅਤੇ ਹੋਸਪੀਟਲ ਤੋਂ ਹੀ ਸਾ ਪੰਜ ਲੱਖ ਵਾਲਾ ਕਾਰਡ ਬਣਾ ਦਿੱਤਾ ਜਾਂਦਾ ਹੈ